ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਮੈਨੂੰ ਤੁਹਾਡਾ ਨੰਬਰ ਮਿਲਿਆ ਸੀ ਆਪਣੇ ਫਰੈਂਡ ਤੋਂ ਮੈਂ ਨਿਊ ਆਇਆ ਫਤਿਹਗੜ੍ਹ ਸਾਹਿਬ ਮੈਨੂੰ ਥੋੜ੍ਹੀ ਹਿਸਟਰੀ ਚਾਹੀਦੀ ਸੀ ਪਤਾ ਕਰਨਾ ਸੀਗਾ ਵੀ ਕਿੱਦਾਂ ਫਤਿਹਗੜ੍ਹ ਸਾਹਿਬ ਦੇ ਇਤਿਹਾਸ ਦਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂ ਜੀ ਹਾਂਜੀ ਆਮ ਖਾਸ ਬਾਗ